ਪੰਜਾਬੀ ਭਾਸ਼ਾ ਦੀ ਵਰਤੋਂ ਹੋਰ ਵੀ ਕਾਫੀ ਜਗ੍ਹਾ 'ਤੇ ਕੀਤੀ ਜਾਂਦੀ ਹੈ ਸਾਹਿਤ ਕਵਿਤਾ ਤੋਂ ਇਲਾਵਾ ਨੋਵਲ ਕਹਾਣੀ ਨਿਬੰਧ ਲੇਖ ਆਦਿ ਵਿੱਚ ਵੀ ਇਹਦਾ ਪ੍ਰਯੋਗ ਕੀਤਾ ਜਾਂਦਾ ਹੈ ਇੱਕ ਸੀਗੇ ਕਵੀ ਜਿਨ੍ਹਾਂ ਦਾ ਨਾਮ ਸੀਗਾ ਸ਼ਹਾਦਤ ਹੁਸਨ ਮਨਟੋ ਜਿਨ੍ਹਾਂ ਨੇ ਪਹਿ ਜਿਨ੍ਹਾਂ ਦੀ ਪਹਿਲੀ ਕਹਾਣੀ ਸੀਗੀ ਤਮਾਸ਼ਾ ਉਹਦੇ ਵਿੱਚ ਇੱਕ ਸੱਤ ਸਾਲ ਦੇ ਬੱਚੇ ਨੂੰ ਮਤਲਬ ਸੱਤ ਸਾਲ ਦੇ ਬੱਚੇ ਦੀਆਂ ਅੱਖਾਂ ਤੋਂ ਜਲ੍ਹਿਆਂਵਾਲਾ ਬਾਗ ਦਾ ਜਿਹੜਾ ਸੀਗਾ ਦ੍ਰਿਸ਼ ਦ ਦਰਸਾਇਆ ਗਿਆ ਸੀਗਾ ਅਤੇ ਉਹਨਾਂ ਦੀ ਪਹਿਲੀ ਕਿਤਾਬ ਸੀਗੀ ਆਤਿਸ਼ ਪਰਰੇ ਫੇਰ ਇੱਕ ਕਵਿੱਤਰੀ ਹੋਈ ਕਵਿੱਤਰੀ ਕਹਿ ਸਕਦੇ ਹਾਂ ਲੇਖਕ ਨਾਵਲਕਾਰ ਨਿਬੰਧਕਾਰ ਜਿਨ੍ਹਾਂ ਦਾ ਨਾਮ ਸੀ ਅੰਮ੍ਰਿਤਾ ਪ੍ਰੀਤਮ ਉਸ ਤੋਂ ਬਾਅਦ ਸੁਰਜੀਤ ਪਾਤਰ ਦਾ ਤਾਂ ਨਾਮ ਸਭ ਨੇ ਸੁਣਿਆ ਹੀ ਹੋਵੇਗਾ ਉਹਨਾਂ ਨੇ ਉਰਦੂ ਵਿੱਚੋਂ ਗਜ਼ਲਾਂ ਨੂੰ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਸੀਗਾ ਫਿਰ ਮਿਰਜ਼ਾ ਗਾਲਿਬ ਇੱਦਾਂ ਹੋ ਹੀ ਨਹੀਂ ਸਕਦਾ ਕਿ ਮਿਰਜ਼ਾ ਗਾਲਿਬ ਬਾਰੇ ਕਿਸੇ ਨੇ ਨਾ ਸੁਣਿਆ ਹੋਵੇ ਉਹਨਾਂ ਨੇ ਵੀ ਕਾਫੀ ਗਜ਼ਲਾਂ ਲਿਖੀਆਂ ਹੋਈਆਂ ਸੀ ਫਿਰ ਸ਼ਿਵ ਫਿਰ ਆਉਂਦੇ ਨੇ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੇ ਬੜੀਆਂ ਹੀ ਜ਼ਿਆਦਾ ਕਵਿਤਾਵਾਂ ਲਿਖੀਆਂ ਹੋਈਆਂ ਸੀ ਕੁਝ ਜ਼ਿਆਦਾਤਰ ਸੈਡ ਅਤੇ ਰੋਮੈਂਟਿਕ ਹੀ ਜਿੱਦਾਂ ਕਿ ਰੂਹਾਂ ਨੂੰ ਛੂਹਣਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਲੂਣਾ ਆਟੇ ਦੀ ਚਿੜੀ ਇਹਨਾਂ ਨੇ ਆਪਣੀ ਪਹਿਲੀ ਕਵਿਤਾ ਆਪਣੇ ਬ੍ਰੇਕਅਪ ਤੋਂ ਬਾਅਦ ਲਿਖੀ ਸੀਗੀ